ਮੈਨੂੰ ਫਲ ਖਾਣਾ ਅਤੇ ਇਹਦੇ ਸਬਜ਼ੀਆਂ ਉਗਾਉਣ ਦਾ ਬੜਾ ਸ਼ੌਂਕ ਹੈ ਮੈਂ ਫੁੱਲ ਬੂਟੇ ਐਰਾ ਵਗੈਰਾ ਆਪਣੇ ਘਰਾਂ ਦੇ ਗਮਲਿਆਂ ਵਿਚ ਵੀ ਲਗਾਏ ਹਨ ਅਤੇ ਮੈਂ ਇੱਕ ਵਾਰੀ ਆਪਣੇ ਫਲ ਅਤੇ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੇਰੇ ਕੋਲ ਉਹ ਟੈਕਲ ਨਹੀਂ ਇੰਨਾ ਹੋਇਆ ਕਿਉਂਕਿ ਇਹਨੂੰ ਕਿੰਨੀ ਖਾਦ ਚਾਹੀਦੀ ਹੈ ਕਿੰਨਾ ਪਾਣੀ ਚਾਹੀਦੀ ਹੈ ਕਿੰਨੀ ਧੁੱਪ ਚਾਹੀਦੀ ਹੈ ਇਹ ਕੈਲਕੂਲੇਸ਼ਨ ਤਾਂ ਕਰਨੀ ਹਾਲੀ ਸੰਭਵ ਨਹੀਂ ਲੱਗਦੀ ਸੀ ਨਾ ਪਰ ਅਗਰ ਘਰ ਵਿੱਚ ਸਬਜ਼ੀਆਂ ਉਗਾਈਆਂ ਜਾਣ ਅਤੇ ਉਹ ਉਹ ਬਿਲ ਖਾਈ ਖਾਧੀਆਂ ਜਾਣ ਤਾਂ ਉਹ ਫ਼ਾਇਦੇਮੰਦ ਵੀ ਹਨ ਕਿਉਂਕਿ ਇਹ ਔਰਗੈਨਿਕ ਹੋਣਗੀਆਂ ਅਤੇ ਬਿਲਕੁਲ ਸਾਫ਼ ਸੁਥਰੀਆਂ ਅਤੇ ਘਰ ਵਿੱਚ ਸਸਤੀਆਂ ਵੀ ਪੈਂਦੀਆਂ ਹਨ ਹਾਂਜੀ ਮੈਂ ਇਸ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਅਨੁਭਵ ਇਹੋ ਹੀ ਹੋਇਆ ਕਿ ਮੈਨੂੰ ਹਜੇ ਥੋੜ੍ਹਾ ਜਿਹਾ ਨਾ ਹੋਰ ਇਹਦੇ ਵਿੱਚ ਕਿਸੇ ਕਿਤੇ ਕੋਲੋਂ ਸਿੱਖਣੀਆਂ ਚਾਹੀਦਾ ਹੈ ਸਿੱਖਣਾ ਚਾਹੀਦਾ ਵੀ ਇਹਨੂੰ ਕਿਸ ਤਰ੍ਹਾਂ ਉਗਾਉਣਾ ਚਾਹੀਦਾ ਵਾ ਕਿਸ ਤਰ੍ਹਾਂ ਬੀਜ ਪਾਉਣੇ ਹੈ ਕਿਹੜੀ ਰੁੱਤ ਵੇਲੇ ਬੀਜ ਪਾਉਣੇ ਹੈ ਕਿੰਨੀ ਖਾਦ ਦੇਣੀ ਹੈ ਕਦੋਂ ਕਿੰਨਾ ਪਾਣੀ ਦੇਣਾ ਅਤੇ ਧੁੱਪ ਰੱਖਣੀ ਕਿ ਛਾਵੇਂ ਰੱਖਣਾ ਇਹ ਇਹ ਵੀ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਟ ਕਰਦਿਆਂ ਫਿਰ ਹੀ ਅਸੀਂ ਫਲ ਅਤੇ ਸਬਜ਼ੀਆਂ ਉਗਾਉਣ 'ਚ ਮੈਂ ਮਾਹਿਰ ਹੋ ਸਕਾਂਗਾ ਕਿਉਂਕਿ ਇਸ ਤੋਂ ਬਗੈਰ ਮੈਨੂੰ ਤਾਂ ਹਾਲੀ ਅਨੁਭਵ ਤੋਂ ਇਹੋ ਹੀ ਸਿੱਖਿਆ ਕਿ ਬਈ ਹਾਲੀ ਥੋੜ੍ਹਾ ਟਾਈਮ ਮੈਨੂੰ ਰੁਕ ਕੇ ਜਾਂ ਕਿਸੇ ਦੇ ਕੋਲੋਂ ਸਿੱਖ ਕੇ ਕਿਸੇ ਨੂੰ ਨਾਲ ਲਗਾ ਕੇ ਜਾਂ ਕਿਸੇ ਦੇ ਅੰਡਰ ਥੋੜ੍ਹਾ ਸਿੱਖ ਕੇ ਫਿਰ ਹੀ ਮੈਨੂੰ ਆਪਣੇ ਇੱਧਰ ਉੱਧਰ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ ਅਤੇ ਬਾਕੀ ਮੈਂ ਫੁੱਲ ਸਬਜ਼ੀਆਂ ਨਾ ਸੀ ਮੈਂ ਫੁੱਲ ਫੁੱਲ ਆਪਣੇ ਫੁੱਲ ਗਮਲਿਆਂ ਵਿੱਚ ਵਗੈਰਾ ਲਗਾਉਂਦਾ ਰਹਿੰਦਾ ਹਾਂ ਅਤੇ ਹਾਲੀ ਹੋਰ ਹਾਲੀ ਤਾਂ ਮੈਂ ਹਾਲੀ ਫੁੱਲਾਂ ਨਾਲ ਹੀ ਫੁੱਲ ਹੀ ਉਗਾ ਰਿਹਾ ਹਾਲੀ ਬਾਕੀ ਸਬਜ਼ੀਆਂ ਮੈਂ ਬਾਅਦ ਚੋਂ ਦੇਖਾਂਗਾ ਬਾਅਦ ਚੋਂ ਸਿੱਖ ਕੇ ਫਿਰ ਇਹਨੂੰ ਲਗਾਉਣੀਆਂ ਸ਼ੁਰੂ ਕਰਾਂਗਾ ਸ਼ੁਕਰੀਆ ਜੀ